ਪੰਜਾਬ ਇੱਕ ਹਿਸਟੋਰੀਕਲ ਪਲੇਸ ਹੈ ਪੰਜਾਬ ਵਿੱਚ ਸਿੱਖ ਧਰਮਾਂ ਦੇ ਸਥਾਪਨਾ ਇਥੋਂ ਹੀ ਹੋਈ ਹੈ ਮਨੋਰੰਜਨ ਇਹ ਪੰਜਾਬ ਜਿਹੜਾ ਹੈ ਆਪਣਾ ਸਿੱਖ ਧਰਮਾਂ ਨਾਲ ਬਹੁਤ ਹੀ ਪੰਜਾਬ ਪੰਜਾਬ ਵਿੱਚ ਪੰਜਾਬੀ ਬੰਦੇ ਜਿਹੜੇ ਆਪਣੇ ਇੰਡੀਆ ਤੋਂ ਬਾਹਰ ਗਏ ਵੇ ਉੱਥੇ ਵੀ ਇਹਨਾਂ ਦਾ ਬੋਲ ਬਾਲਾ ਬਹੁਤ ਵਧੀਆ ਹੈ ਪੰਜਾਬੀ ਭਾਸ਼ਾ ਦਾ ਹੁਣ ਜਿਵੇਂ ਆਪਾਂ ਦੂਸਰੇ ਰਾਜਾਂ ਦਾ ਕੰਪੇਅਰ ਕਰਦੇ ਹਾਂ ਪੰਜਾਬੀ ਆਪਣੇ ਪੰਜਾਬੀ ਸੌਂਗ ਫਿਲਮ ਆਰਟ ਕੋਈ ਵੀ ਇੱਕ ਤਰ੍ਹਾਂ ਦਾ ਕੁਛ ਨਾ ਕੁਛ ਬੋਲੀਵੁੱਡ 'ਚ ਵੀ ਲਿਆ ਜਾਂਦਾ ਹੈ ਕੋਈ ਨਾ ਕੋਈ ਨਾਟਕ 'ਚ ਵੀ ਹੈ ਕੋਈ ਹਰੇਕ ਚੀਜ਼ 'ਚ ਪੰਜਾਬੀ ਆਰਟ ਚਾਹੇ ਕੋਈ ਵੀ ਸਿੰਗਿੰਗ ਗਾਣਾ ਕੁਛ ਨਾ ਕੁਛ ਇਹ 'ਚੋਂ ਲਿਆ ਹੀ ਜਾਂਦਾ ਹੈ ਪੰਜਾਬੀ ਸਭਿਅਤਾ ਇੱਕ ਹਿਸਟੋਰੀਕਲ ਹੈ ਨਾਲੇ ਇਹ ਪੰਜਾਬ ਸਿੱਖ ਧਰਮ ਬਹੁਤ ਫੇਮਸ ਹੈ ਸੇਵਾਵਾਂ ਲਈ ਬਹੁਤ ਫੇਮਸ ਹੈ ਇਹ ਕੋਈ ਵੀ ਪੰਜਾਬ ਵਿੱਚ ਕੋਈ ਵੀ ਬਾਹਰਲਾ ਬੰਦਾ ਭੁੱਖਾ ਨਹੀਂ ਰਹਿ ਸਕਦਾ ਹੈ ਕਿਉਂਕਿ ਇੱਥੇ ਬਹੁਤ ਜ਼ਿਆਦਾ ਧਰਮ ਧਰਮੀ ਬੰਦੇ ਨੇ ਬਹੁਤ ਜ਼ਿਆਦਾ ਸੇਵਾਵਾਂ ਕਰਦੇ ਨੇ ਇੱਥੇ ਕੋਈ ਵੀ ਬੰਦਾ ਵਧੀਆ ਐਨ ਵਧੀਆ ਤਰੀਕੇ ਨਾਲ ਰਹਿ ਸਕਦੇ ਅਤੇ ਬਹੁਤ ਜ਼ਿਆਦਾ ਗੁਰਦੁਆਰੇ ਨੇ ਆਪਣੇ ਪੰਜਾਬ ਵਿੱਚ ਹੀ ਨਹੀਂ ਗੁਰਦੁਆਰੇ ਗੁਰਦੁਆਰੇ ਬਹੁਤ ਬਾਹਰ ਨੇ ਜਿੱਦਾਂ ਜਿੱਥੇ ਜਿੱਥੇ ਪੰਜਾਬ ਦੇ ਲੋਕ ਵਸੇ ਨੇ ਉੱਥੇ ਉੱਥੇ ਗੁਰਦੁਆਰੇ ਨੇ ਇਹ ਸਮਝ ਸਕਦੇ ਨੇ